ਕਿੱਤਾ ਮਨੁੱਖ ਦੇ ਜੀਵਨ ਵਿੱਚ ਬਹੁਤ ਵੱਡਾ ਯੋਗਦਾਨ ਰੱਖਦਾ ਹੈ ਜੇਕਰ ਕਿੱਤੇ ਦੀ ਗੱਲ ਕਰੀਏ ਤਾਂ ਮੋਹਾਲੀ ਖੇਤਰ ਦੇ ਅੰਦਰ ਲੋਕ ਆਪਣਾ ਕਿੱਤਾ ਦੁੱਧ ਨੂੰ ਮੁੱਖ ਰੱਖਦੇ ਹਨ ਕਿਉਂਕਿ ਮੋਹਾਲੀ ਜ਼ਿਲ੍ਹਾ ਯੂ ਟੀ ਚੰਡੀਗੜ੍ਹ ਦੇ ਨਾਲ ਜੁੜਿਆ ਹੋਇਆ ਹੋਣ ਕਰਕੇ ਔਰ ਨੇੜੇ ਪੈਣ ਕਰਕੇ ਦੁੱਧ ਦਾ ਕਾਰੋਬਾਰ ਬਹੁਤ ਹੀ ਮਹੱਤਵਪੂਰਨ ਲਾਹੇਵੰਦ ਰੱਖਦਾ ਹੈ ਔਰ ਇਸ ਖੇਤਰ ਦੇ ਅੰਦਰ ਜਿੱਥੇ ਸਾਡਾ ਜੀਵਨ ਪੱਧਰ ਆਰਥਿਕ ਤੌਰ 'ਤੇ ਉੱਚਾ ਉੱਠਦਾ ਹੈ ਉੱਥੇ ਸਾਡੇ ਸਮਾਜ ਨੂੰ ਚੰਗੀ ਸੇਧ ਮਿਲਦੀ ਹੈ ਅਤੇ ਇਹਦੇ ਨਾਲ ਮੋਹਾਲੀ ਜ਼ਿਲ੍ਹੇ ਦਾ ਆਰਥਿਕ ਪੱਧਰ ਬਹੁਤ ਉੱਚਾ ਉੱਠਦਾ ਹੈ